ਰਾਣਾ ਭਾਰਤ ਭੂਸ਼ਣ ਪਿੰਡ ਮਿਰਜਾਪੁਰ ਦਾ ਰਹਿਣ ਵਾਲਾ ਹਾਂ ਜ਼ਿਲ੍ਹਾ ਪਠਾਨਕੋਟ ਦਾ ਅਤੇ ਜੇਕਰ ਗਾਉਣ ਦੀ ਗੱਲ ਕੀਤੀ ਜਾਵੇ ਤਾਂ ਮੈਨੂੰ ਤਾਂ ਬਚਪਨ ਤੋਂ ਹੀ ਸ਼ੌਂਕ ਸੀ ਗਾਣੇ ਗੂਣੇ ਗਾਉਣ ਦਾ ਅਤੇ ਮੈਂ ਬਚਪਨ ਤੋਂ ਹੀ ਛੋਟੀ ਛੋਟੀ ਸਟੇਜਾਂ ਤੋਂ ਗਾਂਦੇ ਆਇਆਂ ਅਤੇ ਇਹ ਗਾਣਾ ਗਾਉਣ ਤੋਂ ਪਹਿਲਾਂ ਆਪਣੇ ਫੇਸ ਇੰਪਰੈਸ਼ਨ ਜਾਣੀ ਕਿ ਸਮਾਇਲ ਵਾਲੇ ਹੋਣੇ ਚਾਹੀਦੇ ਹੈ ਅਤੇ ਮੈਂ ਬਚਪਨ ਤੋਂ ਹੀ ਸੋਂਗ ਵਗੈਰਾ ਸੁਣਦਾ ਆਇਆਂ ਪੰਜਾਬੀ ਸੋਂਗ ਤਾਂ ਮੇਰੇ ਵੈਸਟ ਸੋਂਗ ਹੈ ਪੰਜਾਬੀ ਸੋਂਗ ਨੂੰ ਗ ਪੰਜਾਬੀ ਸੋਂਗ ਨੂੰ ਗਾਉਣ ਵਾਸਤੇ ਪਹਿਲਾਂ ਤਾਂ ਪੰਜਾਬੀ ਆਉਣੀ ਚਾਹੀਦੀ ਹੈ ਦੂਜਾ ਪੰਜਾਬੀ ਏ ਪੰਜਾਬੀ ਵਿੱਚ ਗਾਣਾ ਗਾਉਣ ਲਈ ਸੋਹਣੇ ਸੋਹਣੇ ਲਫ਼ਜ ਜਿੱਦਾਂ ਹਾਸੇ ਵਾਲੇ ਲਫ਼ਜ ਹੋਣੇ ਚਾਹੀਦੇ ਹੈ ਅਤੇ ਪੰਜਾਬੀ ਸੋਂਗ ਗਾਂਦੇ ਗਾਂਦੇ ਅਤੇ ਬਹੁਤ ਵਧੀਆ ਸੋਂਗ ਗਾਉਣੇ ਚਾਹੀਦੇ ਹੈ ਅਤੇ ਜੇਕਰ ਸੁਣਨ ਵਾਲੇ ਨੂੰ ਅੱਛੇ ਨਹੀਂ ਲੱਗਣ ਉਸੇ ਹਿਸਾਬ ਦੇ ਮਾਹੌਲ ਦੇ ਹਿਸਾਬ ਨਾਲ ਇਹ ਗਾਣੇ ਚਾਹੀਦੇ ਹੈ ਜਿੱਦਾਂ ਵਿਆਹ ਦੇ ਵਿੱਚ ਨੱਚਣ ਵਾਲੇ ਗਾਣੇ ਅਤੇ ਜਿੱਦਾਂ ਕਈ ਵਾਰੀ ਦਸਵੀਂ ਵਗੈਰਾ 'ਤੇ ਵੀ ਗਾਣਾ ਗਾਣਾ ਪੈ ਜਾਂਦਾ ਹੈ ਉੱਥੇ ਵੀ ਗਾਣੇ ਜਿਹੜੇ ਉਸੇ ਹਿਸਾਬ ਨਾਲ ਗਾਏ ਜਾਣ ਤਾਂ ਹੀ ਵਧੀਆ ਲੱਗਦੇ ਹੈ ਸੱਭਿਆਚਾਰਕ ਲਈ ਸੱਭਿਆਚਾਰ ਵਾਲੇ ਗਾਣੇ ਅਤੇ ਜੇਕਰ ਕਿਸੇ ਸੰਗਤ ਵਗੈਰਾ ਵਿੱਚ ਗਾਣੇ ਹੋਣ ਤਾਂ ਧਾਰਮਿਕ ਗਾਣੇ ਤਾਂ ਬਹੁਤ ਵਧੀਆ ਤਰੀਕੇ ਨਾਲ ਗਾਣੇ ਪੈਂਦੇ ਹੈ ਜਿਸ ਹਿਸਾਬ ਦਾ ਮਾਹੌਲ ਹੋਵੇ ਉਸੇ ਹਿਸਾਬ ਦੇ ਫੇਸ ਇੰਪਰੈਸ਼ਰ ਬਣਾ ਕੇ ਤਾਂ ਫਿਰ ਹੀ ਇਹ ਗਾਣੇ ਗਾਏ ਜਾਣ ਤਾਂ ਵਧੀਆ ਲੱਗਦਾ ਜੀ ਧੰਨਵਾਦ ਜੀ